ਸ ਰਸੋਈ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਬਰਤਨ ਜੋ ਕਿ ਪਾਏ ਜਾਂਦੇ ਹਨ ਜਿਵੇਂ ਕਿ ਗਲਾਸ ਗਲਾਸਾਂ ਦੇ ਵਿੱਚ ਪਾਣੀ ਪੀਣ ਨੂੰ ਦਿੱਤਾ ਜਾਂਦਾ ਹੈ ਚਾਹ ਪੀਣ ਨੂੰ ਦਿੱਤੀ ਜਾਂਦੀ ਹੈ ਦੁੱਧ ਪੀਣ ਨੂੰ ਦਿੱਤਾ ਜਾਂਦਾ ਆ ਲੱਸੀ ਆਦਿਕ ਜੋ ਕਿ ਤਰਲ ਪਦਾਰਥ ਹਨ ਉਹ ਦਿੱਤੇ ਜਾਂਦੇ ਹਨ ਇਸ ਤਰ੍ਹਾਂ ਪਰਾਤ ਹੈਗੀ ਹੈ ਉਹ ਪਰਾਤ ਦੇ ਵਿੱਚ ਆਟਾ ਗੁੰਨ੍ਹ ਕੇ ਰੋਟੀਆਂ ਬਣਾਉਣ ਲਈ ਪਰਾਤ ਕੰਮ ਆਉਂਦੀ ਹੈ ਕਈ ਵੇਲੇ ਸਬਜ਼ੀ ਕੱਟ ਕੇ ਵੀ ਪਰਾਤ ਦੇ ਵਿੱਚ ਜਦੋਂ ਕਿ ਜ਼ਿਆਦਾ ਰਿਸ਼ਤੇਦਾਰ ਜਾਂ ਜ਼ਿਆਦਾ ਭੋਜਨ ਤਿਆਰ ਕਰਨਾ ਹੋਵੇ ਤਾਂ ਪਰਾਤ ਨੂੰ ਇਹਨਾਂ ਕੰਮਾਂ ਲਈ ਵੀ ਵਰਤਿਆ ਜਾਂਦਾ ਹੈ ਜਿਵੇਂ ਕਿ ਕਈ ਵੇਲੇ ਕਣਕ ਵੀ ਸੁੱਕਣੀ ਪਾਉਂਦੀ ਪਾਈ ਜਾਂਦੀ ਆ ਤਾਂ ਰਸੋਈ ਦੇ ਵਿੱਚੋਂ ਪਰਾਤ ਕੱਢ ਕੇ ਉਹਦੀ ਪਰਾਤ ਦੀ ਵਰਤੋਂ ਕੀਤੀ ਜਾਂਦੀ ਹੈ ਕੜਛੀ ਜਦੋਂ ਸਬਜ਼ੀ ਤਿਆਰ ਹੋ ਕਰਨੀ ਹੁੰਦੀ ਹੈ ਉੱਦੋਂ ਕੜਛੀ ਦਾ ਕੰਮ ਲਿਆ ਜਾਂਦਾ ਹੈ ਕੜਛੀ ਨਾਲ ਸਬਜ਼ੀ ਬਰਤਨਾਂ ਦੇ ਵਿੱਚ ਪਲੇਟਾਂ ਦੇ ਵਿੱਚ ਪਾਈ ਜਾਂਦੀ ਹੈ ਪਲੇਟਾਂ ਥਾਲੀਆਂ ਜਿਨ੍ਹਾਂ ਵਿੱਚ ਰੋਟੀ ਪਾ ਕੇ ਦਿੱਤੀ ਜਾਂਦੀ ਹੈ ਕੋਲੀਆਂ ਜਿਨ੍ਹਾਂ ਦੇ ਵਿੱਚ ਸਬਜ਼ੀ ਪਾ ਕੇ ਦਿੱਤੀ ਜਾਂਦੀ ਹੈ ਦਹੀਂ ਪਾ ਕੇ ਦਿੱਤਾ ਜਾਂਦਾ ਆ ਖਾਣ ਨੂੰ ਮਿੱਠੀਆਂ ਚੀਜ਼ਾਂ ਪਾ ਕੇ ਦਿੱਤੀਆਂ ਜਾਂਦੀਆਂ ਹਨ ਕੱਪ ਜੋ ਕਿ ਜਿਨ੍ਹਾਂ ਦੇ ਵਿੱਚ ਚਾਹ ਰਿਸ਼ਤੇਦਾਰਾਂ ਨੂੰ ਕੌਫੀ ਆਦਿਕ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ ਚਮਚੇ ਜਿਨ੍ਹਾਂ ਨਾਲ ਆਪਾਂ ਸਬਜ਼ੀ ਦਹੀਂ ਖਾਂਦੇ ਹਾਂ ਜਾਂ ਮਿੱਠੀ ਚੀਜ਼ ਖਾਂਦੇ ਹਾਂ ਚੱਕਲਾ ਵੇਲਣਾ ਜੋ ਕਿ ਰੋਟੀ ਬਣਾਉਣ ਲਈ ਕੰਮ ਆਉਂਦਾ ਹੈ ਤਵੇ ਦੇ ਉੱਤੇ ਰੱਖ ਕੇ ਰੋਟੀ ਬਣਾਈ ਜਾਂਦੀ ਹੈ ਗੈਸ ਸਿਲੰਡਰ ਜੋ ਕਿ ਰਸੋਈ ਦਾ ਹੀ ਇੱਕ ਹਿੱਸਾ ਹੁੰਦੇ ਹਨ ਇਸ ਤਰੀਕੇ ਨਾਲ ਹੋਰ ਵੀ ਕਈ ਕੱਚ ਦੇ ਬਰਤਨ ਹੁੰਦੇ ਹਨ ਚੀਨੀ ਦੇ ਬਰਤਨ ਹੁੰਦੇ ਹਨ ਜੋ ਕਿ ਰਸੋਈ ਵਿੱਚ ਵਰਤੇ ਜਾਂਦੇ ਹਨ